ਹਾਂਜੀ ਇਹ ਮਿਸਜ ਗਿਲ ਬੋਲ ਰਹੇ ਆ ਹਾਂਜੀ ਜੀ ਮੈਂ ਮੈਂ ਬੋਲਦੀ ਹਾਂ ਮਿਸਜ ਚੱਡਾ ਅਤੇ ਮੇ ਹਾਂਜੀ ਜੀ ਮੇਰੇ ਹਸਬੈਂਡ ਦਾ ਨਾ ਹੁਣੇ ਟਰਾਂਸਫਰ ਹੋਇਆ ਅਤੇ ਮੈਂ ਨਾ ਤੁਹਾਡੇ ਜਿਵੇਂ ਆਪਾਂ ਹੁਣ ਮਿਲੇ ਸੀਗੇ ਹਾਂਜੀ ਵੀ ਉਵੇਂ ਮਤਲਬ ਕਿ ਅਸੀਂ ਥੋੜ੍ਹੇ ਟਾਈਮ ਪਹਿਲਾਂ ਹੀ ਟਰਾਂਸਫਰ ਹੋਇਆ ਮੇਰੇ ਹਸਬੈਂਡ ਦਾ ਅਤੇ ਉਹ ਇੱਥੇ ਫੂਡ ਸਪਲਾਈ ਵਿੱਚ ਕੰਮ ਕਰਦੇ ਆ ਅਤੇ ਬਸ ਜਿਵੇਂ ਹੁਣ ਇੱਥੇ ਤੁਹਾਨੂੰ ਵੀ ਪਤਾ ਵੀ ਬਾਬਾ ਫਰੀਦ ਜੀ ਦਾ ਸ਼ਹਿਰ ਆ ਹੈ ਨਾ ਅਤੇ ਬਾਕੀ ਮੇਰੇ ਹਸਬੈਂਡ ਦਾ ਟਰਾਂਸਫਰ ਵੀ ਹੁੰਦਾ ਹੀ ਰਹਿੰਦਾ ਤਾਂ ਫਿਰ ਜਿਵੇਂ ਮੈਂ ਜਿਹੜੀ ਵੀ ਮੈਂ ਜਿਹੜੀ ਵੀ ਮਤਲਬ ਕਿ ਡਿਸਟਰਿਕਟ ਜਾਂ ਫਿਰ ਜਿਹੜੇ ਵੀ ਨਵੇਂ ਸ਼ਹਿਰ 'ਚ ਆਉਂਦੀ ਹਾਂ ਤਾਂ ਫਿਰ ਮੈਨੂੰ ਹਿਸਟਰੀ ਜਾਣਨ ਦਾ ਬੜਾ ਸ਼ੌਕ ਹੁੰਦਾ ਤਾਂ ਫਿਰ ਮੈਂ ਤੁਹਾਨੂੰ ਵੀ ਤਾਂ ਪੁੱਛਣਾ ਸੀ ਵੀ ਜਿਵੇਂ ਮੈਂ ਕੁਛ ਇੱਥੇ ਘੁੰਮ ਲਵਾਂ ਜਾਂ ਫਿਰ ਗੁਰਦੁਆਰਿਆਂ ਬਾਰੇ ਵੀ ਹੈ ਨਾ ਕੁਝ ਜਾਣ ਪਾਵਾਂ ਮੈਂ ਕਿਹਾ ਵੀ ਪਹਿਲਾਂ ਜਿਵੇਂ ਤੁਹਾਨੂੰ ਜ਼ਿਆਦਾ ਨੌਲੇਜ ਹੋਊਗੀ ਤੁਸੀਂ ਇੱਥੇ ਪਹਿਲਾਂ ਤੋਂ ਰਹਿੰਦੇ ਹੋ ਤਾਂ ਮੈਂ ਕਿਹਾ ਵੀ ਤੁਹਾਡੇ ਤੋਂ ਪਹਿਲਾਂ ਇਨਫੋਰਮੇਸ਼ਨ ਲੈ ਲਵਾਂ ਮੈਂ ਤੁਹਾਡੇ ਤੋਂ ਪੁੱਛਣਾ ਸੀ ਵੀ ਜਿਵੇਂ ਆਪਣੇ ਇੱਥੇ ਫਰੀਦਕੋਟ ਬਾਬਾ ਗੋਦੜੀ ਗੁਰਦੁਆਰਾ ਗੋਦੜੀ ਸਾਹਿਬ ਹੈ ਵੀ ਉਹਦੀ ਅਤੇ ਉਹਦੀ ਉਹਦੀ ਹਿਸਟਰੀ ਕੀ ਹੈ ਤੁਸੀਂ ਥੋੜ੍ਹਾ ਦੱਸੋਗੇ ਮੈਨੂੰ

ਹਾਂਜੀ ਹਮ ਅੱਛਾ ਅੱਛਾ ਹਾਂਜੀ ਅੱਛਾ ਹਾਂਜੀ ਹਾਂਜੀ ਹਾਂਜੀ

ਹਾਂਜੀ

ਹਾਂਜੀ ਅੱਛਾ

ਹਾਂਜੀ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਕਦੀ ਆਇਓ ਸਾਡੇ ਘਰ ਚਾਹ ਪੀਣ ਤੁਹਾਡਾ ਬਹੁਤ ਬਹੁਤ ਧੰਨਵਾਦ